ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਇੱਕ ਤਾਂ ਜਿਵੇਂ ਇਕੱਲਾ ਰਾਨੀਹਾਰ ਹੋ ਜਾਂਦਾ ਰਾਨੀਹਾਰ ਦੇ ਨਾਲ ਤੁਸੀਂ ਇੱਕ ਉਹ ਨੈੱਕ ਦੇ ਨਾਲ ਲੱਗਦਾ ਉਹ ਵੀ ਨਾਲ ਤਿਆਰ ਕਰਵਾਉਣਾ ਇੱਕ ਤਾਂ ਲੋਂਗ 'ਚ ਹੋ ਗਿਆ ਇੱਕ ਈ ਬਣਵਾਉਣਾ ਠੀਕ ਏ ਜੀ ਇੱਕ ਨੈਕਲਸ ਹੋਜੇਗਾ ਨਾਲ ਏਅਰਿੰਗ ਹੋ ਜਾਣਗੇ ਟਿੱਕਾ ਹੋਜੇਗਾ ਹਾਂਜੀ ਨਹੀਂ ਨਹੀਂ ਰਿੰਗ ਵਗੈਰਾ ਨੀਗੀ ਬਸ ਟਿੱਕਾ ਈ ਹੋਏਗਾ ਹਾਂਜੀ ਮਤਲਬ ਸਟਾਰਟਿੰਗ ਤੁਸੀਂ ਲਾ ਲਓ ਵੈਸੇ ਆਪਾਂ ਨੋਰਮਲ ਚਾਰ ਪੰਜ ਤੋਲੇ ਦਾ ਵਧੀਆ ਬਣ ਜੇਗਾ ਨਾ ਜਿਆਦਾ ਹੈਵੀ ਤੇ ਹਾਂਜੀ ਹਾਂਜੀ ਪੰਜ ਤੋਲਿਆਂ ਚ ਸਹੀ ਹੋਜੇਗਾ ਹਾਂਜੀ ਨਹੀਂ ਕੁਛ ਬਣੇ ਬਣਾਏ ਵੀ ਤਿਆਰ ਹੁੰਦੇ ਐ ਜੇ ਤੁਸੀਂ ਬਣਵਾਉਣਾ ਚਾਮੋ ਤਾਂ ਉਹ ਵੀ ਤਿਆਰ ਹੋ ਜਾਣਗੇ ਜਿਵੇਂ ਕਈ ਵਾਰ ਆਪਣੀ ਇੱਛਾ ਹੁੰਦੀ ਐ ਆਪਾਂ ਡਿਜ਼ਾਇਨ ਕਿਸੇ ਤੋਂ ਵੇਖਕੇ ਕਹਿਨੇ ਆ ਵੀ ਐਵੇਂ ਦੀ ਤਿਆਰ ਕਰਾ ਲਈਏ ਉਹ ਵੀ ਹੋਜੇਗੀ ਬਾਕੀ ਕੁਛ ਤਿਆਰ ਵੀ ਪਏ ਹੁੰਦੇ ਨੇ ਜੇ ਉਹਨਾਂ ਚੋਂ ਕੋਈ ਪਸੰਦ ਆ ਜਾਵੇ ਕਿਵੇਂ ਉਹ ਨੀ ਮੈਂ ਸਮਝੀ ਐਡਜਸਟੇਬਲ ਕਿਵੇਂ ਕਹਿਨੇ ਓ ਤੁਸੀਂ ਹਾਂ ਉਹ ਜਿਵੇਂ ਆਪਾਂ ਉਹ ਜਿਵੇਂ ਰੈਡੀ ਕਰਵਾਉਣੀ ਹੋਵੇ ਉਨਦਾ ਹੋਜੇਗਾ ਹਾਂਜੀ ਹਾਂਜੀ ਉਹ ਵੀ ਹੈਗਾ ਉਵੇਂ ਵੀ ਹੋ ਜਾਂਦਾ ਏ ਹਾਂਜੀ ਹਾਂ ਸੈੱਟ ਦਾ ਵੀ ਤੁਸੀਂ ਡਿਜ਼ਾਇਨ ਵਗੈਰਾ ਆਪਣੀ ਇੱਛਾ ਨਾਲ ਬਣਾਉਣਾ ਚਾਹੁਨੇ ਓ ਤਾਂ ਉਹ ਵੀ ਤਿਆਰ ਹੋ ਜਾਂਦਾ ਏ ਹਾਂਜੀ ਉਹ ਵੀ ਤਿਆਰ ਹੋਜੇਗਾ ਬਾਕੀ ਤੇ ਜਿਵੇਂ ਕੁਛ ਤਿਆਰ ਪਏ ਹੁੰਦੇ ਨੇ ਕੁਛ ਬਾਕੀ ਆਪਾਂ ਤੁਸੀਂ ਆਪਦੀ ਮਰਜ਼ੀ ਨਾਲ ਕਰਾਉਣਾ ਚਾਹੁਨੇ ਓ ਉਹ ਵੀ ਡਿਜ਼ਾਇਨ ਹੋਜੇਗਾ ਜਿਵੇਂ ਵਿੱਚ ਕਈ ਵਾਰ ਆਪਾਂ ਨੂੰ ਹੁੰਦਾ ਕੀ ਇਹਦੇ ਵਿੱਚ ਆਪਾਂ ਸਟੋਨ ਵਗੈਰਾ ਪਵਾਉਣੇ ਚਾਹੁਨੇ ਆਂ ਜਿਵੇਂ ਰੁੱਬੀ ਵਗੈਰਾ ਹਾਂਜੀ ਹਾਂਜੀ ਠੀਕ ਐ ਜੀ ਹਾਂਜੀ ਹਾਂਜੀ ਬਿਲਕੁਲ ਹਾਂਜੀ ਠੀਕ ਏ ਜੀ ਹਾਂਜੀ ਓਕੇ ਜੀ ਓਕੇ ਜੀ